ਮੈਮ ਤੁਸੀਂ ਨਿਸ਼ਾ ਬੋਲ ਰਹੇ ਹੋ ਮੈਮ ਮੈਂ ਨਾ ਤੁਹਾਡਾ ਗਆਂਢੀ ਨਵਾਂ ਆਇਆ ਪਹਿਲਾਂ ਮੈਂ ਨਾ ਚੰਡੀਗੜ੍ਹ ਰਹਿੰਦਾ ਸੀਗਾ ਫਿਰ ਮੇਰੀ ਬਦਲੀ ਹੋ ਕੇ ਇੱਥੇ ਨਵਾਂ ਸ਼ਹਿਰ ਆ ਗਿਆ ਮੈਂ ਕਹਿੰਦਾ ਮੈਂ ਤੁਹਾਡੇ ਤੋਂ ਇਹ ਪੁੱਛਣਾ ਸੀਗਾ ਕਿਤੇ ਇੱਥੇ ਸਬਜ਼ੀਆਂ ਕਿੱਥੇ ਵਧੀਆ ਮਿਲਦੀ ਹੈ

ਅੱਛਾ ਜੀ ਹਾਂਜੀ ਅਤੇ ਹੋਮ ਡਿਲੀਵਰੀ ਵੀ ਹੈਗਾ ਉੱਥੇ ਠੀਕ ਹੈ ਜੀ ਜੀ ਉਹ ਸਬਜ਼ੀ ਐਨ ਵਧੀਆ ਹੁੰਦੀ ਹੈ

ਅਤੇ ਕਿਆ ਕਿਆ ਰੇਟ ਦਿੰਦੇ ਹੈ ਸਬਜ਼ੀ ਉਹ ਅੱਛਾ ਜੀ ਅਤੇ ਮੀਨਜ਼ ਮੇਰੇ ਕੋਲ ਨਾ ਟਾਈਮ ਨੇ ਅੱਜ ਟਾਈਮ ਨਹੀਂ ਹੈ ਕੱਲ੍ਹ ਨੂੰ ਨਾ ਮੈਨੂੰ ਛੁੱਟੀ ਹੈ ਅਤੇ ਕੱਲ੍ਹ ਤੁਸੀਂ ਤੁਹਾਡੇ ਕੋਲ ਟਾਈਮ ਹੋਇਆ ਤਾਂ ਮੇਰੇ ਨਾਲ ਚੱਲੋਗੇ ਸ਼ਾਮ ਨੂੰ ਮੈਂ ਚਾਰ ਵਜੇ ਤੱਕ ਫ੍ਰੀ ਹੁੰਦਾ ਹੈ

ਠੀਕ ਹੈ ਜੀ ਕੋਲ ਕਰ ਲਿਓ ਇੱਕ ਵਾਰੀ ਫਿਰ ਨਾਲ ਚੱਲਿਓ ਹਾਂਜੀ ਮੋਟਰਸਾਈਕਲ ਹੈਗਾ ਮੇਰੇ ਕੋਲ ਠੀਕ ਹੈ ਜੀ

ਠੀਕ ਹੈ ਜੀ ਧੰਨਵਾਦ